ਜਿਹੜੇ ਜਾਨਵਰ ਅਵਾਰਾ ਹਨ ਜਿਨ੍ਹਾਂ ਨੂੰ ਲੋਕ ਘਰੋਂ ਕੱਢ ਦਿੰਦੇ ਹਨ ਉਹਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਛੱਡ ਦਿੰਦੇ ਹਨ ਉਹਨਾਂ ਦੇ ਲਈ ਚਰਾਉਣ ਦੇ ਲਈ ਕੋਈ ਵੀ ਜਗ੍ਹਾ ਇੱਦਾਂ ਅਵੇਲੇਵਲ ਨਹੀਂ ਹੈ ਜਿਨ੍ਹਾਂ ਨੇ ਰੱਖੇ ਹੋਏ ਹਨ ਜਿਨ੍ਹਾਂ ਦੀ ਆਪਦੀਆਂ ਜਗ੍ਹਾ ਹਨ ਜਾਂ ਜਿਨ੍ਹਾਂ ਕਈ ਵਾਰੀ ਸਰਕਾਰ ਕਈ ਵਾਰੀ ਜਗ੍ਹਾ ਨੂੰ ਐਕਵਾਇਰ ਕਰ ਲੈਂਦੀ ਹੈ ਜਿਸਦੇ ਕਰਕੇ ਉਹ ਜਗ੍ਹਾ ਨੂੰ ਫਿਰ ਬੰਜਰ ਹੋ ਜਾਂਦਾ ਉੱਥੇ ਕੁਛ ਹੁੰਦਾ ਨਹੀਂ ਕਈ ਸਾਲ ਫਿਰ ਉੱਥੇ ਕਈ ਵਾਰੀ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਤਾਂ ਉੱਥੇ ਦੇਸੀ ਘਾਹ ਹੋ ਜਾਂਦਾ ਹੈ ਜਿਹੜਾ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਜਾਨਵਰਾਂ ਨੂੰ ਲੈ ਕੇ ਆਉਂਦੇ ਨੇ ਅਤੇ ਉਹ ਚੁਗਾਉਂਦੇ ਹਨ ਪਰ ਜਿਹੜੇ ਅਵਾਰਾ ਜਾਨਵਰ ਹਨ ਉਹਨਾਂ ਦੇ ਲਈ ਚੁਗਣ ਦੇ ਲਈ ਕੋਈ ਸਪੈਸ਼ਲ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਉਹਨਾਂ ਨੂੰ ਚੁਗਣਾ ਮਿਲ ਜਾ ਮਿਲ ਜਾਵੇ ਅਤੇ ਇਹਦੇ ਨਾਲ ਜਾਨਵਰਾਂ 'ਤੇ ਵੀ ਬੁਰਾ ਅਸਰ ਪੈਂਦਾ ਜਿੱਦਾਂ ਬਾਰਿਸ਼ ਹੁੰਦੀ ਆ ਮੌਸਮ ਹੁੰਦਾ ਅਤੇ ਉਹ ਜਾਨਵਰ ਕਈ ਵਾਰੀ ਬਿਮਾਰ ਹੋ ਜਾਂਦੇ ਹਨ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਕੋਈ ਉਹਨਾਂ ਨੂੰ ਉੱਥੇ ਦੇਖ ਰੇਖ ਨਹੀਂ ਹੈਗੀ ਅਤੇ ਆਮ ਤੌਰ 'ਤੇ ਪਾਣੀ ਦੀ ਵੀ ਉਹਨਾਂ ਨੂੰ ਪਾਣੀ ਪੀਣ ਦੀ ਕਮੀ ਹੋ ਜਾਂਦੀ ਕਿਉਂਕਿ ਉਹ ਜਦੋਂ ਬਾਹਰ ਤੁਰਦੇ ਫਿਰਦੇ ਨੇ ਉਹਨਾਂ ਨੂੰ ਕੁਛ ਇੱਧਰ ਉੱਧਰ ਨਹੀਂ ਮਿਲਦਾ ਜਾਂ ਫਿਰ ਲੋਕਾਂ ਨੇ ਫਸਲਾਂ ਦੇ ਵਿੱਚ ਦਵਾਈ ਦਵੂਈ ਛਿੜਕੀ ਹੁੰਦੀ ਆ ਅਤੇ ਉਹ ਕਈ ਵਾਰੀ ਜਾਨਵਰ ਪਾਣੀ ਪੀ ਕੇ ਉਹ ਮਰ ਜਾਂਦੇ ਹਨ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਮਾਤਰਾ 'ਚ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਜਾਨਵਰ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ ਅਤੇ ਜ਼ਿਆਦਾਤਰ ਜਾਨਵਰ ਬਾਹਰ ਜਿਹੜੇ ਅੱਜ ਕੱਲ੍ਹ ਅਵਾਰਾ ਹਨ ਗਾਂਈਆਂ ਹਨ ਜਾਂ ਬੈ ਬੈਲ ਹਨ ਉਹਨਾਂ ਦਾ ਅੱਜ ਤੌਰ 'ਤੇ ਬਹੁਤ ਬੁਰਾ ਹਾਲ ਹੈ ਜਾਂ ਤਾਂ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਇੱਥੇ ਸੜਕਾਂ ਦੇ ਉੱਤੇ ਮਰ ਰਹੇ ਹਨ ਅਤੇ ਲੋਕਾਂ ਨੂੰ ਵੀ ਮਾਰ ਰਹੇ ਹਨ